ਜਦੋਂ ਵੀ ਤੁਸੀਂ ਅਸੀਂ ਕੋਈ ਵੀ ਖੇਡ ਖੇਡਦੇ ਹਾਂ ਤਾਂ ਉਹਦੇ 'ਚ ਦੋ ਹੀ ਹੁੰਦੇ ਹਨ ਦੋ ਰਾਹ ਹੁੰਦੇ ਹਨ ਜਾਂ ਤਾਂ ਜਿੱਤਣਾ ਜਾਂ ਤਾਂ ਹਾਰਨਾ ਜਾਂ ਤਾਂ ਸਫਲਤਾ ਜਾਂ ਅਸਫਲਤਾ ਤਾਂ ਜਦੋਂ ਵੀ ਕੋਈ ਵੀ ਵਿਅਕਤੀ ਖੇਡਾਂ ਦੇ ਵਿੱਚ ਭਾਗ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇਹ ਤੁਹਾਡਾ ਮਲਕੀ ਬਿਲਕੁਲ ਸਾਫ ਹੋਣਾ ਚਾਹੀਦਾ ਏ ਆ ਆਪਣਾ ਮੌਕਾ ਆਪਣਾ ਉਦੇਸ਼ ਕਿ ਚਾਹੇ ਅਸੀਂ ਹਾਰੀਏ ਚਾਹੇ ਅਸੀਂ ਜਿੱਤੀਏ ਸਾਡਾ ਇਹ ਕਰਮ ਹੈ ਅਤੇ ਇਹੀ ਖੇਡਾਂ ਦਾ ਨਤੀਜਾ ਹੁੰਦਾ ਏ ਆ ਜੇ ਸਫਲਤਾ ਹੁੰ ਜਦੋਂ ਅਸੀਂ ਸਫਲਤਾ ਕਿਸੇ ਵੀ ਖੇਡ ਦੇ ਵਿੱਚ ਸਫਲਤਾ ਹਾਸਿਲ ਕਰਦੇ ਹਾਂ ਤਾਂ ਅਸੀਂ ਦੇਖਣਾ ਚਾਹੀਦਾ ਅਸੀਂ ਇਵੇਂ ਦਾ ਕੀ ਕੀਤਾ ਖੇਡ ਦੇ ਵਿੱਚ ਜਿਹਦੇ ਕਰਕੇ ਸਾਨੂੰ ਸਫਲਤਾ ਮਿਲੀ ਕਿ ਸਾਡੀ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਟੀਮ ਟੀਮ ਸੀ ਖਿਡਾਰੀ ਸੀ ਆਪਸ ਵਿੱਚ ਰਲ ਮਿਲ ਕੇ ਖੇਡੇ ਹਨ ਉਹਨਾਂ ਨੇ ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਿਹਦੇ ਕਰਕੇ ਸਾਰੀ ਟੀਮ ਨੂੰ ਜਾਂ ਖਿਡਾਰੀਆਂ ਨੂੰ ਸਫਲਤਾ ਪ੍ਰਾਪਤ ਹੋਈ ਅਤੇ ਜੇ ਅਸੀਂ ਅਸਫਲਤਾ ਹਾਸਿਲ ਕਰਦੇ ਹਾਂ ਤਾਂ ਉਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਸਾਨੂੰ ਅਸਫਲਤਾ ਕਿਉਂ ਹਾ ਹਾਸਲ ਹੋਈ ਆ ਕੀ ਕਾਰਨ ਸੀ ਕਿ ਅਸੀਂ ਸਾਨੂੰ ਅਸਫਲਤਾ ਜਾਂ ਸਾਡੀ ਟੀਮ ਪੂਰੀ ਹਾਰੀ ਆ ਕਿ ਸਾਡੀ ਟੀਮ ਦੇ ਵਿੱਚ ਕੋਈ ਕਮੀ ਸੀ ਜਾਂ ਸਾਡੇ ਖੇਡਣ ਦੇ ਵਿੱਚ ਕੋਈ ਕਮੀ ਸੀ ਜਾਂ ਅਸੀਂ ਕੋਈ ਨਿਯਮਾਂ ਦਾ ਪਾਲਣਾ ਜਾਂ ਉਲੰਘਣ ਕੀਤਾ ਹੈ ਅਤੇ ਖੇਡਾਂ ਨੂੰ ਹੋਰ ਬਿਹਤਰ ਬਿਹਤਰ ਬਣਾਉਣ ਲਈ ਸਭ ਤੋਂ ਪਹਿਲਾਂ ਖਿਡਾਰੀ ਦੇ ਮਨ ਵਿੱਚ ਇਹ ਜਿਹੜਾ ਉਹਨਾਂ ਦਾ ਕੋਚ ਹੁੰਦਾ ਆ ਜਾਂ ਉਹਨਾਂ ਦਾ ਆਪਣਾ ਲੀਡਰ ਹੁੰਦਾ ਸਾਰਿਆਂ ਦੇ ਖਿਡਾਰੀਆਂ ਦੇ ਮਨ ਵਿੱਚ ਪਹਿਲਾਂ ਇਹ ਸਾਰਿਆਂ ਦਾ ਮਤਲਬ ਕਿ ਸਾਫ ਨਿ ਟੀਚਾ ਹੋਣਾ ਚਾਹੀਦਾ ਕਿ ਚਾਹੇ ਅਸੀਂ ਜਿੱਤੀਏ ਚਾਹੇ ਅਸੀਂ ਹਾਰੀਏ ਸਾਡਾ ਬਸ ਮੁੱਖ ਕੰਮ ਕੀ ਹੈ ਚੰਗੀ ਤਰ੍ਹਾਂ ਨਿਯਮਾਂ ਦਾ ਪਾਲਣਾ ਕਰਦੇ ਹੋਏ ਖੇਡਣਾ ਅਤੇ ਇੱਕ ਚੰਗੇ ਖਿਡਾਰੀ ਦੇ ਵਾਂਗ ਖੇਡਣਾ ਅਤੇ ਮੈਂ ਜਦੋਂ ਹੁੰਦੀ ਸੀ ਦਸ ਆਪਣਾ ਨੌਵੀਂ ਕਲਾਸ ਦੇ ਵਿੱਚ ਤਾਂ ਸਾਡੇ ਇੱਥੇ ਕਰਾਟੇ ਸਿਖਾਏ ਜਾਂਦੇ ਸਨ ਅਤੇ ਉਹ ਕਰਾਟੇ ਸਾਨੂੰ ਇੱਕ ਸਰ ਸਿਖਾਉਣ ਆਉਂਦੇ ਸੀ ਤਾਂ ਉਹਨਾਂ ਨੇ ਸਾਡੇ ਦਿਮਾਗ ਵਿੱਚ ਪਹਿਲਾਂ ਇਹੀ ਗੱਲ ਪਾਈ ਕਿ ਇਹ ਤੁਹਾਡੀ ਸੁਰੱਖਿਆ ਲਈ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਤੋਂ ਕਿਵੇਂ ਬਚਾ ਸਕਦੇ ਹੋ ਜੇ ਤੁਸੀਂ ਅੱਗੇ ਮੁਕਾਬਲੇ ਵਿੱਚ ਜਾਂਦੇ ਰਹੋ ਤੁਸੀਂ ਜਾਂ ਤਾਂ ਸਫਲ ਹੋਊਗੇ ਜਾਂ ਤਾਂ ਅਸਫਲ ਹੋਊਗੇ ਤਾਂ ਮਤਲਬ ਕਿ ਖੇਡ ਦੇ ਵਿੱਚ ਮੈਂ ਆਪਣੇ ਸਕੂਲ ਦੇ ਵਿੱਚ ਪਹਿਲੇ ਨੰਬਰ 'ਤੇ ਅਤੇ ਉਸ ਤੋਂ ਬਾਅਦ ਅਸੀਂ ਬਲੋਕ ਲੈਵਲ 'ਤੇ ਗਏ ਬਲੋਕ ਲੈਵਲ 'ਤੇ ਜਦੋਂ ਅਸੀਂ ਗਏ ਤਾਂ ਸਾਡੇ ਉੱਥੇ ਤਿੰਨ ਪੱਧ ਤਿੰਨ ਪੱਧਰੀ ਮੁਕਾਬਲਾ ਹੋਇਆ ਪਹਿਲੇ ਪੱਧਰ ਵਿੱਚ ਬਸ ਮੇਰਾ ਇਹੀ ਮਕਸਦ ਸੀ ਕਿ ਮੈਂ ਕਿਸ ਤਰੀਕੇ ਨਾਲ ਖੇਡਣਾ ਆ ਕਿਸੇ ਰੂਲ ਨੂੰ ਬਿਨਾਂ ਕਿਉਂਕਿ ਉੱਥੇ ਕਾਫੀ ਮਲਕੀ ਤਰੀਕੇ ਉਹ ਇਵੇਂ ਦੇ ਸੀ ਜਿਹਦੇ ਵਿੱਚ ਜੇਕਰ ਅਸੀਂ ਗਲਤ ਤਕਨੀਕ ਦਾ ਯੂਜ ਕਰਦੇ ਹਾਂ ਲੜਨ ਦੇ ਵਿੱਚ ਕਰਾਟੇ ਕਰਨ ਦੇ ਵਿੱਚ ਤਾਂ ਸਾਡੇ ਮਾਈਨ ਨੰਬਰ ਘੱਟ ਜਾਂਦੇ ਹਨ ਤਾਂ ਮੈਂ ਸਾਰੇ ਨਿਯਮਾਂ ਦਾ ਪਾਲਣਾ ਕਰਦੇ ਹੋਏ ਉਲੰਘਣਾ ਨਾ ਕਰਦੇ ਹੋਏ ਮੈਂ ਆਪਣਾ ਪੂਰੀ ਮਨ ਨਾਲ ਉਸ ਖੇਡ ਨੂੰ ਖੇਡੀ ਅਤੇ ਉੱਥੇ ਤਿੰਨ ਪੱਧਰਾਂ ਮੁਕਾਬਲਾ ਹੋਇਆ ਸੀ ਅਤੇ ਮੈਂ ਤਿੰਨੇ ਪੱਧਰੀ ਮੁਕਾਬਲਿਆਂ ਵਿੱਚ ਜਿੱਤੀ ਅਤੇ ਮੈਨੂੰ ਗਲਡ ਗੋਲਡ ਮੈਡਲ ਪ੍ਰਾਪਤ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਦਸਵੀਂ ਦੇ ਵਿੱਚ ਦੁਬਾਰਾ ਇਹ ਕਰਾਟੇ ਸਿਖਾਉਣ ਸਾਨੂੰ ਆਏ ਤਾਂ ਸਾਡੀ ਮੈਡਮ ਬਦਲ ਗਈ ਸੀ ਤਾਂ ਫਿਰ ਉਹਨਾਂ ਨੇ ਸਾਨੂੰ ਸਿਖਾਇਆ ਅਤੇ ਮੈਂ ਪ ਆਪਣਾ ਜ਼ਿਲ੍ਹਾ ਪੱਧਰ 'ਤੇ ਇਹ ਮੁਕਾਬਲਾ ਕਰਨ ਗਏ ਪਰ ਉੱਥੇ ਮੈਂ ਹਾਰ ਗਈ ਕਿਉਂਕਿ ਜਿਹੜਾ ਮੇਰੇ ਸਾਹਮਣੇ ਵਾਲਾ ਖਿਡਾਰੀ ਸੀ ਉਹਨਾਂ ਉਹ ਕਾਫੀ ਚੰਗੀ ਤਰ੍ਹਾਂ ਉਹਨਾਂ ਨੇ ਅਭਿਆਸ ਕੀਤਾ ਹੋਇਆ ਸੀ ਅਤੇ ਉਹਨਾਂ ਮਤਲਬ ਕਿ ਮੈਂ ਵੀ ਕਾਫੀ ਆਪਣਾ ਚੰਗਾ ਬਿਹਤਰ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਜਗ੍ਹਾ 'ਤੇ ਜਾ ਕੇ ਹਾਰ ਗਈ ਅਤੇ ਪਰ ਫਿਰ ਵੀ ਮੈਂ ਆਪਣੀ ਹਾਰ ਦੇ ਨਾਲ ਨਜਿੱਠਿਆ ਅਤੇ ਉਹਨੂੰ ਸਵੀਕਾਰ ਕੀਤਾ ਕਿ ਉਹ ਖਿਡਾਰੀ ਮੇਰੇ ਨਾਲ ਬਿਹਤਰ ਸੀ ਅਤੇ ਮੈਂ ਉਹੀ ਖਿਡਾਰੀ ਵਾਂਗ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣਾ ਹੈ